ਉੱਨੀ ਸੌ ਚੁਰਾਸੀ ਇਹ ਉਹ ਭਿਆਨਕ ਸਮਾਂ ਹੈ ਵੀ ਜਦੋਂ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਸੀਗਾ ਦਰਬਾਰ ਸਾਹਿਬ ਨੂੰ ਚਾਰ ਚੁਫੇਰਿਓਂ ਘੇਰ ਲਿਆ ਗਿਆ ਸੀਗਾ ਅਤੇ ਚਾਰ ਜੂਨ ਉੱਨੀ ਸੌ ਚੁਰਾਸੀ ਤੋਂ ਲੈ ਕੇ ਛੇ ਜੂਨ ਉੱਨੀ ਸੋ ਚੁਰਾਸੀ ਤੱਕ ਵੀ ਬਹੁਤ ਜੰਗਾਂ ਹੋਈਆਂ ਹੈ ਜਿਹਦੇ ਵਿੱਚ ਸਰਦਾਰ ਫਨ ਜਰਨੈਲ ਸਿੰਘ ਭਿੰਡਰਾਵਾਲੇ ਸ਼ਹੀਦ ਹੋਏ ਛੇ ਜੂਨ ਨੂੰ ਇਹ ਉਹ ਭਿਆਨਕ ਸਮਾਂ ਅੱਜ ਓਥ ਸਮਾਂ ਹੈ ਜੋ ਅੱਜ ਤੱਕ ਵੀ ਆਪਾਂ ਨੂੰ ਭੁੱਲ ਨਹੀਂ ਸਕਿਆ ਉੱਥੇ ਹੋਰ ਵੀ ਬਹੁਤ ਬੇਕਸੂਰ ਵਿਚਾਰੇ ਮਾਰੇ ਗਏ ਜੋ ਵਿਚਾਰੇ ਦਰਬਾਰ ਸਾਹਿਬ ਮੱਥਾ ਟੇਕਣ ਆਏ ਸਨ ਅਤੇ ਉੱਥੇ ਬਹੁਤ ਜ਼ਿਆਦਾ ਦੰਗੇ ਹੋਏ ਕਈ ਬੇਕਸੂਰਾਂ ਦੀਆਂ ਜਾਨਾਂ ਗਈਆਂ ਦਰਬਾਰ ਸਾਹਿਬ ਨੂੰ ਚਾਰ ਚੁਫੇਰਿਓਂ ਘੇਰਿਆ ਦਰਬਾਰ ਸਾਹਿਬ 'ਤੇ ਬਹੁਤ ਭਿਆਨਕ ਹਮਲਾ ਹੋਇਆ ਇਹ ਉੱਨੀ ਸੌ ਚੁਰਾਸੀ ਦਾ ਕਿੱਸਾ ਜੋ ਅੱਜ ਤੱਕ ਵੀ ਆਪਣੇ ਮਨਾਂ ਤੋਂ ਨਹੀਂ ਲਹਿ ਸਕਿਆ ਨਾ ਹੀ ਆਪਾਂ ਭੁੱਲ ਸਕੇ ਜੋ ਸ਼ਹੀਦ ਹੋਏ ਨਾ ਉਹਨਾਂ ਦਾ ਪਰਿਵਾਰ ਅੱਜ ਤੱਕ ਇਹ ਘਟਨਾਵਾਂ ਨੂੰ ਭੁੱਲ ਸਕਿਆ ਇਹ ਆਪਣੇ ਸਿੱਖ ਕੌਮ ਅਤੇ ਪੰਜਾਬ 'ਤੇ ਬਹੁਤ ਡੂੰਘਾ ਅਸਰ ਪਿਆ ਇਹ ਤਾਣਾ ਬਾਣਾ ਸਮਾਜ ਵਿੱਚ ਆਪਣੇ ਬਹੁਤ ਗਹਿਰਾ ਅਸਰ ਹੋਇਆ ਜਿਹਨਾਂ ਦੇ ਵਿਚਾਰਿਆਂ ਦੇ ਬੇਕਸੂਰ ਸ਼ਹੀਦ ਹੋਏ ਗਏ ਕਈਆਂ ਦੀਆਂ ਜਾਨਾਂ ਗਈਆਂ ਉਹਨਾਂ ਦਾ ਪਰਿਵਾਰ ਵੀ ਅੱਜ ਤੱਕ ਇਹ ਸਦਮੇ ਨੂੰ ਨਹੀਂ ਭੁੱਲ ਸਕਿਆ ਇਹ ਉੱਨੀ ਸੌ ਚੁਰਾਸੀ ਅੱਜ ਤੱਕ ਆਪਾਂ ਨੂੰ ਯਾਦ ਹੈ ਆਪਣੇ ਮਨਾਂ ਵਿੱਚ ਵੱਸਦਾ ਹੈ ਧੰਨਵਾਦ